ਕੱਪੜਿਆਂ ਨੂੰ ਜੋ ਹੱਥੀਂ ਬਣਾਉਂਦੇ ਹਨ ਉਸ ਦੇ ਵਿੱਚ ਸੂਤੀ ਜੋ ਸੂਤ ਹੈ ਉਸ ਦਾ ਇਸਤੇਮਾਲ ਕਰਕੇ ਬਣਾਇਆ ਜਾਂਦਾ ਹੈ ਰੇਸ਼ਮ ਹੈ ਰੇਸ਼ਮ ਦੀ ਵਰਤੋਂ ਕਰਕੇ ਰੇਸ਼ਮੀ ਕੱਪੜੇ ਬਣਾਏ ਜਾਂਦੇ ਹਨ ਜੋ ਕਿ ਇੱਕ ਮਲਮਲ ਹੈ ਜੋ ਕਿ ਢਾਕੇ ਦੀ ਮਲਮਲ ਬਹੁਤ ਮਸ਼ਹੂਰ ਹੈ ਉਸ ਦਾ ਇਸਤੇਮਾਲ ਕਰਕੇ ਮਲਮਲ ਦੇ ਕੱਪੜੇ ਬਣਾਏ ਜਾਂਦੇ